ਪੰਜਾਬ ਵਿੱਚ ਸਿੱਖ ਧਰਮ ਦੀ ਬਹੁਤ ਮਹੱਤਤਾ ਹੈ ਆਪਣੇ ਰਾਜਾ ਰਾਜਾ ਸਾਹਿਬ ਜਾਂਦੇ ਮੱਥਾ ਟੇਕਣ ਸੱਚੇ ਮਨ ਨਾਲ ਮੱਥਾ ਟੇਕ ਕੇ ਆਓ ਹਰੇਕ ਰ ਆਪਣੇ ਰੀਝ ਪੂਰੀ ਹੁੰਦੀ ਹੈ ਸੱਚੇ ਮਨ ਨਾਲ ਮੱਥਾ ਟੇਕੋ ਸਵੇਰੇ ਸ਼ਾਮ ਪਾਠ ਕਰੋ ਸੱਚੇ ਮਨ ਨਾਲ ਜਿਹੜੀ ਚੀਜ਼ ਤੁਸੀਂ ਮੰਗਦੇ ਹੋ ਓਹ ਚੀਜ਼ ਤੁਹਾਡੀ ਰੀਝ ਪੂਰੀ ਹੁੰਦੀ ਹੈ ਆਪਣੇ ਸ਼੍ਰੀ ਅੰਮ੍ਰਿਤਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਜਿਹਨੂੰ ਗੋਲਡਨ ਟੈਂਪਲ ਦੇ ਨਾਮ ਨਾਲ ਜਾਣਿਆ ਜਾਂਦਾ ਉਹ ਤਾਂ ਸ਼੍ਰੀ ਗ੍ਰੰਥ ਸਾਹਿਬ ਗ੍ਰੰਥ ਸ਼੍ਰੀ ਗ੍ਰੰਥ ਸਾਹਿਬ ਪਿਆ ਉੱਥੇ ਮੱਥਾ ਟੇਕਣ ਬੰਦਾ ਮ ਸੱਚੇ ਮਨ ਨਾਲ ਮੱਥਾ ਟੇਕਣਾ ਪੈਂਦਾ ਆਪਣੀ ਹਰੇਕ ਰੀਝ ਪੂਰੀ ਹੁੰਦੀ ਹੈ ਸੱਚੇ ਮਨ ਨਾਲ ਜਾਓ ਸਵੇਰੇ ਸ਼ਾਮ ਜਪੁਜੀ ਸਾਹਿਬ ਦਾ ਪਾਠ ਕਰੋ ਨਹੀਂ ਤਾਂ ਆਪਣੇ ਘਰ ਆਪਣੇ ਘਰ ਮੱਥਾ ਟੇਕੋ ਜਪੁਜੀ ਸਾਹਿਬ ਦਾ ਪਾਠ ਕਰੋ ਸਵੇਰੇ ਸ਼ਾਮ ਹਰ ਇੱਕ ਖਵਾਇਸ਼ ਪੂਰੀ ਹੁੰਦੀ ਹੈ ਜੇ ਆਪਾਂ ਸੱਚੇ ਮਨ ਨਾਲ ਫਿਰ ਜੇ ਆਪਾਂ ਸੱਚੇ ਮਨ ਨਾਲ ਰੀਝ ਪੂਰੀ ਸੱਚੇ ਮਨ ਨਾਲ ਕੁਛ ਮੰਗਾਂਗੇ ਹਰੇਕ ਰੀਝ ਪੂਰੀ ਕਰਦਾ ਸੱਚੇ ਮਨ ਨਾਲ ਮੱਥਾ ਟੇਕਣਾ ਚਾਹੀਦਾ ਆ ਜਾਂ ਸੱਚੇ ਮਨ ਨਾਲ ਜਾਓ ਕਿਸੇ ਦੀ ਬੁਰਾਈ ਨਾ ਕਰੋ ਸਿੱਖ ਧਰਮ ਕੀਤੀ ਜਾਂਦੀ ਹੈ ਸਿੱਖ ਧਰਮ ਵਿੱਚ ਸਵੇਰੇ ਆਪਣੇ ਸਵੇਰੇ ਸ਼ਾਮ ਮੱਥਾ ਟੇਕਣਾ ਪੈਂਦਾ